ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਅਸੀਂ ਨਾ ਤੁਹਾਡੇ ਤੋਂ ਕੈਬ ਬੁੱਕ ਕਰਵਾਇਆ ਸੀਗਾ ਹਾਂਜੀ ਕਿਸੇ ਪ੍ਰੋਬਲਮ ਕਰਕੇ ਨਾ ਅਸੀਂ ਉਥੇ ਜਾਣਾ ਨਹੀਂ ਹੈਗਾ ਸਾਨੂੰ ਕੋਈ ਕੰਮ ਪੈ ਗਿਆ ਹਾਂਜੀ ਅਸੀਂ ਉੱਥੇ ਜਾ ਨਹੀਂ ਸਕਦੇ ਅਤੇ ਬਾਕੀ ਅਸੀਂ ਜਿਹੜੇ ਤੁਹਾਨੂੰ ਪੈਸੇ ਦਿੱਤੇ ਸੀਗੇ ਉਹ ਸਾਡੇ ਤੁਸੀਂ ਨਾ ਵਾਪਸ ਕਰ ਦਿਉ ਹਾਂਜੀ ਜੇ ਕਹਿੰਦੇ ਹੋ ਤਾਂ ਗੂਗਲ ਪੇ ਕਰ ਦਿਉ ਨਹੀਂ ਤਾਂ ਪੇਟੀਐੱਮ ਕਰ ਦਿਉ ਹਾਂਜੀ ਨਹੀਂ ਜੀ ਅਸੀਂ ਜਾਣਾ ਨਹੀਂ ਹੈਗਾ ਤੁਸੀਂ ਸਾਡੇ ਪੈਸੇ ਵਾਪਸ ਕਰ ਦਿਉ ਤੁਹਾਡਾ ਬਹੁਤ ਧੰਨਵਾਦ